ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼ੁਰੂ ਤੋਂ ਲੈ ਕੇ ਉਹ ਅੰਤ ਤੱਕ ਮੰਨੋਰੰਜਨ ਦੇ ਸਾਧਨਾਂ ਨਾਲ ਭਰਿਆ ਪਿਆ ਹੈ ਪੰਜਾਬ 'ਚ ਅਗਰ ਅਸੀਂ ਗੱਲ ਕਰੀਏ ਇਤਿਹਾਸਿਕ ਤੌਰ 'ਤੇ ਵੀ ਸਾਡੇ ਕੋਲ ਦੇਖਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਫੋਰ ਇਗਜ਼ਾਂਪਲ ਸਾਡੇ ਕੋਲ ਸਾਡੇ ਕੋਲ ਹਰਿਮੰਦਰ ਸਾਹਿਬ ਹੈ ਅਸੀਂ ਉੱਥੇ ਰਲੀਜੀਅਸ ਪਲੇਸ ਅਗਰ ਕੋਈ ਮੰਨਦਾ ਤਾਂ ਆਪਾਂ ਉੱਥੇ ਜਾ ਸਕਦੇ ਹਾਂ ਸਾਡੇ ਕੋਲ ਵਿਰਾਸਤ ਏ ਖਾਲਸਾ ਹੈ ਸਾਡੇ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਕਿਲ੍ਹੇ ਵਗੈਰਾਂ ਨੇ ਉਹ ਵੀ ਹੈ ਦੇਖਣ ਵਾਲੇ ਅਤੇ ਜੇਕਰ ਕੋਈ ਹਿਸਟੋਰੀਕਲੀ ਦੇ ਵਿੱਚ ਰੁਚੀ ਨਹੀਂ ਰੱਖਦਾ ਤਾਂ ਸਾਡੇ ਕੋਲ ਪਬ ਕਲੱਬ ਸਾਰਾ ਕੁਝ ਚੰਡੀ ਮੋਹਾਲੀ ਸਾਈਡ ਸਾਰਾ ਕੁਝ ਸਾਡੇ ਕੋਲ ਪਬ ਕਲੱਬ ਰੈਸਟੋਰੈਂਟ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਹੈ ਸਾਡੇ ਕੋਲ ਸ਼ੋਪਿੰਗ ਮੌਲ ਬਹੁਤ ਵਧੀਆ ਵਧੀਆ ਨੇ ਅਤੇ ਜੇਕਰ ਕੋਈ ਸ਼ੋਪਿੰਗ ਮੌਲ ਦੇ ਵਿੱਚ ਜਾ ਕੇ ਸ਼ੋਪਿੰਗ ਕਰਨਾ ਪਸੰਦ ਨਹੀਂ ਕਰਦਾ ਤਾਂ ਸਾਡੇ ਕੋਲ ਜਿਹੜੀ ਸਾਡੀ ਰੇਹੜੀ ਮਾਰਕੀਟ ਹੈ ਪੰਜਾਬ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਪ੍ਰਚੱਲਿਤ ਹੈ ਜਿਵੇਂ ਕਿ ਸਾਡੀ ਪਟਿਆਲਾ ਵਗੈਰਾ ਹੈ ਪਟਿਆਲਾ ਸ਼ਹਿਰ ਦੇ ਵਿੱਚ ਜਿਹੜੀ ਪਟਿਆਲਾ ਦੀ ਮਾਰਕਿਟ ਹੈ ਉਹ ਬਹੁਤ ਪ੍ਰਚੱਲਿਤ ਮੰਨੀ ਜਾਂਦੀ ਹੈ ਅਤੇ ਉਹਦੀਆਂ ਪੰਜਾਬੀ ਜੁੱਤੀਆਂ ਪੰਜਾਬੀ ਜਿਹੜੀਆਂ ਫੁੱਲਕਾਰੀਆਂ ਨੇ ਉਹ ਅਮ ਜਿਹੜੀਆਂ ਕਿ ਪਟਿਆਲੇ ਦੀਆਂ ਬਹੁਤ ਫੇਮਸ ਨੇ ਪੂਰੇ ਭਾਰਤ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਉੱਥੋਂ ਜਿਹੜੀਆਂ ਜੁੱਤੀਆਂ ਨੇ ਮੰਗਵਾ ਕੇ ਪਹਿਨਣਾ ਬਹੁਤ ਪਸੰਦ ਕਰਦੇ ਹਨ